ਹਾਂ ਸ਼ੀਤਲ ਬੋਲਦੀ ਪਈ ਹੈ ਨਮਸਤੇ ਬਈ ਮੈਡਮ ਜੀ ਸ਼ੀਤਲ ਅਸੀਂ ਨਾ ਅੜੀਏ ਉੱਥੇ ਪਠਾਨਕੋਟ ਘੁੰਮਣ ਗਏ ਹੀ ਐਂ ਗੁਰਦੁਆਰੇ ਜਾਣਾ ਹੈ ਮੱਥਾ ਟੇਕਣ ਕੋਈ ਗੁਰਦੁਆਰਾ ਹੈ ਜੋ ਤੈਨੂੰ ਪਤਾ ਕਿ ਦਸਾਂ ਮੈਨੂੰ ਅਸੀਂ ਘੁੰਮਣ ਜਾਣਾ ਉੱਧਰ ਉਹ ਤਾਂ ਮਤਲਬ ਉੱਧਰ ਜਾਣਾ ਹੋਵੇ ਕਾਹਦੇ 'ਤੇ ਜਾਣਾ ਪੈਂਦਾ ਬੱਸ 'ਤੇ ਆਟੋ 'ਤੇ ਜਾਂ ਕਿਹੜਾ ਰਸਤਾ ਅਸੀਂ ਕਦੇ ਗਏ ਨਹੀਂ ਉੱਧਰ ਸਾਨੂੰ ਰਸਤੇ ਦਾ ਨਹੀਂ ਪਤਾ ਅਤੇ ਪਠਾਨਕੋਟ ਆਉਣਾ ਹੁੰਦਾ ਜਾਂ ਸੁਜਾਨਪੁਰੋ ਅੱਛਾ ਅੱਛਾ ਅਤੇ ਅੱਗੇ ਠੀਕ ਹੈ ਠੀਕ ਹੈ ਅਸੀਂ ਕਹਿਣਡੇ ਤੇ ਨਾ ਜਾਣਾ ਅਤੇ ਮੈਨੂੰ ਰਸਤੇ ਦਾ ਨਹੀਂ ਪਤਾ ਹੈਗਾ ਵੀ ਕਿੱਧਰ ਨੂੰ ਜਾਂਦਾ ਵੀ ਕਿੱਧਰ ਨੂੰ ਨਹੀਂ ਜਾਂਦਾ ਹੈਗਾ ਮੈਂ ਕਿਹਾ ਚਲੋ ਸ਼ੀਤਲ ਨੂੰ ਪੁੱਛਦੀ ਹਾਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਸਾਨੂੰ ਲੈ ਜੀ ਫਿਰ ਠੀਕ ਹੈ ਠੀਕ ਹੈ ਜੀ